ਅੱਜ ਦੇ ਯੁੱਗ ਵਿੱਚ ਭਾਰਤ ਵਿੱਚ ਬਹੁਤ ਮਹੱਤਵਪੂਰਨ ਚੁਣੌਤੀਆਂ ਹਨ ਇਹ ਮਹੱਤਵਪੂਰਨ ਚੁਣੌਤੀਆਂ ਕਾਰਨ ਹੀ ਭਾਰਤ ਬਾਕੀ ਦੇਸ਼ਾਂ ਦੇ ਵਿਕਾਸ ਵਿੱਚ ਪਿੱਛੇ ਰਹਿ ਗਿਆ ਇਹ ਚੁਣੌਤੀਆਂ ਅਨਪੜ੍ਹਤਾ ਪ੍ਰਦੂਸ਼ਣ ਬੇਰੁਜ਼ਗਾਰੀ ਵਧਦੀ ਆਬਾਦੀ ਹਨ ਇਹ ਮਹੱਤਵਪੂਰਨ ਚੁਣੌਤੀਆਂ ਹਨ ਜਿਹਨਾਂ ਕਾਰਨ ਹੀ ਭਾਰਤ ਦੇਸ਼ ਵਿਕਾਸ ਨਹੀ ਕਰ ਪਾ ਰਿਹਾ ਹੈ ਅਨਪੜ੍ਹਤਾ ਕਾਰਨ ਲੋਕ ਕਈ ਬੇਰੁਜ਼ਗਾਰ ਰਹਿ ਚੁੱਕੇ ਹਨ ਵੱਧਦੇ ਪ੍ਰਦੂਸ਼ਣ ਕਾਰਨ ਵੀ ਭਾਰਤ ਵਿੱਚ ਬਹੁਤ ਸਾਰੀਆਂ ਚੁਣੌਤੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਜੋ ਕਿ ਭਾਰਤ ਦੇ ਲਈ ਚੰਗੀ ਗੱਲ ਨਹੀਂ ਹੈ ਬੇਰੁਜ਼ਗਾਰੀ ਦੇ ਕਾਰਨ ਵੀ ਕਈ ਲੋਕ ਘਰਾਂ ਵਿੱਚ ਚੋਰੀਆਂ ਕਰਦੇ ਹਨ ਜੋ ਕਿ ਚੰਗੀ ਗੱਲ ਨਹੀਂ ਹੈ ਭਾਰਤ ਨੂੰ ਇਹਨਾਂ ਚੁਣੌਤੀਆਂ ਦਾ ਸਾਹਮਣਾ ਕਰਨ ਲਈ ਵੀ ਕੁਝ ਨਾ ਕੁਝ ਕਰਨਾ ਪੈਂਦਾ ਹੈ ਵੱਧਦੀ ਆਬਾਦੀ ਦੇ ਕਾਰਨ ਲੋਕ ਬੇਰੁਜ਼ਗਾਰ ਅਨਪੜ੍ਹ ਰਹਿ ਰਹੇ ਹਨ ਜੋ ਕਿ ਭਾਰਤ ਲਈ ਚੰਗੀ ਗੱਲ ਨਹੀਂ ਹੈ ਭਾਰਤ ਨੂੰ ਇਹਨਾਂ ਚੁਣੌਤੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਇਸ ਚੁਣੌਤੀਆਂ ਦਾ ਸਾਹਮਣਾ ਕਰਨ ਲਈ ਭਾਰਤ ਨੇ ਕਈ ਸੰਸਥਾਵਾਂ ਖੋਲ੍ਹੀਆਂ ਹਨ ਜਿਹਨਾਂ ਦਾ ਲਾਭ ਸਿਰਫ ਕਈ ਲੋਕ ਹੀ ਉਠਾ ਪਾ ਰਹੇ ਹਨ ਜੋ ਪੜ੍ਹੇ ਲਿਖੇ ਹਨ ਓਹੀ ਲੋਕ ਸਿਰਫ ਇਹਨਾਂ ਦਾ ਵਾਧਾ ਉਠਾ ਪਾ ਰਹੇ ਹਨ ਜਿਹੜੇ ਬੇਰੁਜ਼ਗਾਰ ਹਨ ਓਹ ਇਹਨਾਂ ਦਾ ਵਾਧਾ ਨਹੀਂ ਉਠਾ ਪਾ ਰਹੇ ਹਨ ਕਿਉਂਕਿ ਓਹ ਅਨਪੜ੍ਹ ਹਨ ਜਿਹਨਾਂ ਕਾਰਨ ਓਹਨਾਂ ਨੂੰ ਨੌਕਰੀਆਂ ਨਹੀਂ ਮਿਲ ਰਹੀਆਂ ਹਨ